ਹਾਂਜੀ ਮੈਂ ਮੀਡੀਆ 'ਚੋਂ ਅਜੀਤ ਅਖ਼ਬਾਰ ਵੱਲੋਂ ਰਿਪੋਰਟਰ ਬੋਲ ਰਹੀ ਸੀ ਕਿ ਜਿਹੜੇ ਪਿਛਲੇ ਸਾਲ ਆਪਣੇ ਇੱਥੇ ਸ਼ਹਿਰ ਦੇ ਵਿੱਚ ਫਲੱਡ ਆਏ ਸੀ ਉਹਦੇ ਵਿੱਚ ਜਿਹੜੀ ਲੋਕਾਂ ਦੀ ਬਹੁਤ ਗੰਦੀ ਬੁਰੀ ਹਾਲਤ ਹੋਈ ਗਲੀਆਂ ਦੇ ਵਿੱਚ ਪਾਣੀ ਭਰਨਾ ਜਿਹੜੇ ਗਰੀਬ ਲੋਕ ਝੌਂਪੜੀਆਂ ਉਹਨਾਂ ਦੀਆਂ ਝੌਂਪੜੀਆਂ ਢਹਿ ਗਈਆਂ ਤਾਂ ਤੁਸੀਂ ਉਹਨਾਂ ਲਈ ਕੀ ਕੀਤਾ ਉਸ ਟਾਈਮ 'ਤੇ ਜਦੋਂ ਇਹਨਾਂ ਨੇ ਕੀ ਪ੍ਰਬੰਧ ਕੀਤੇ ਕਿ ਉਹ ਉਹ ਆਪਣੀ ਜਿਹੜੀ ਸਥਿਤੀ ਨੂੰ ਪਾਰ ਕਰ ਸਕਣ ਅਤੇ ਤੁਸੀਂ ਉਹ ਪਹਿਲਾਂ ਹੀ ਕਿਉਂ ਇਹ ਚੀਜ਼ ਨੂੰ ਨਹੀਂ ਸੋਚ ਕੇ ਚੱਲੇ ਕਿ ਜੇ ਇੱਦਾਂ ਦੀ ਸਥਿਤੀ ਹੋਵੇ ਤਾਂ ਲੋਕ ਕਿਵੇਂ ਆਪਣੇ ਜਿਹੜਾ ਰਹਿਣ ਸਹਿਣ ਆ ਉਹ ਕਿਵੇਂ ਕਰਨਗੇ ਖਾਣ ਪੀਣ ਦਾ ਕਿਵੇਂ ਕਰਨਗੇ ਜਿਹੜੇ ਰੋਜ਼ ਕਮਾ ਕੇ ਖਾਣ ਵਾਲੇ ਨੇ ਉਹ ਕਿਵੇਂ ਕੰਮ ਕਰਨ ਆਪਣਾ ਅਤੇ ਉਹਨਾਂ ਕੋਲ ਤਾਂ ਰਹਿਣ ਦਾ ਹੀ ਨਹੀਂ

ਕਿਉਂਕਿ ਲੋਕ ਇਸ ਗੱਲ 'ਤੇ ਬਹੁਤ ਜ਼ਿਆਦਾ ਕ੍ਵੇਸ਼ਚਨ ਰੱਖ ਰਹੇ ਵੀ ਸਾਨੂੰ ਇਹਨਾਂ ਨੇ ਕੋਈ ਇੰਨੀਆਂ ਸਹੂਲਤਾਂ ਨਹੀਂ ਦਿੱਤੀਆਂ ਕਿ ਅਸੀਂ ਇੰਨੇ ਔਖੇ ਟਾਈਮ 'ਚੋਂ ਲੰਘੀਏ ਠੀਕ ਹੈ ਅਤੇ ਹੁਣ ਜੇ ਅਗਲੀ ਵਾਰ ਤੋਂ ਇੱਦਾਂ ਦੀ ਕੋਈ ਸਥਿਤੀ ਆਉਂਦੀ ਹੈ ਤਾਂ ਤੁਸੀਂ ਕੀ ਕਰੋਗੇ ਕਿ ਜੋ ਪਿਛਲੀ ਵਾਰ ਨਹੀਂ ਕਰ ਸਕੇ ਠੀਕ ਹੈ ਚਲੋ ਠੀਕ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਮੈਨੂੰ ਆਪਣਾ ਸਮਾਂ ਦਿੱਤਾ